ਭਾਰਤ ਵਿੱਚ ਪ੍ਰਸਿੱਧ ਗੁਰੂ ਰਾਮਦੇਵ ਹਨ ਜੋ ਕਿ ਆਪਣੇ ਯੋਗਾ ਦੇ ਅਸਣਾ ਰਾਹੀ ਸਭ ਨੂੰ ਮੋਹ ਲੈਂਦੇ ਹਨ ਇਹਨਾਂ ਦੇ ਫੇਮਸ ਆਸਣ ਲੋਕਾਂ ਦਾ ਭਾਰ ਘਟਾਉਣ ਵਿੱਚ ਵੀ ਮਦਦ ਕਰਦੇ ਹਨ ਜੋ ਕਿ ਲੋਕਾਂ ਲਈ ਬਹੁਤ ਲਾਭਦਾਇਕ ਹਨ